ਲਚਕਤਾ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਇਹ ਸਾਨੂੰ ਨਵੇਂ ਹਾਲਾਤਾਂ ਨਾਲ ਢਲਣ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਦਬਾਅ ਨੂੰ ਸੰਭਾਲਣ ਵਿੱਚ ਮਦਦ ਕਰਦੀ ਹੈ ਜਦ ਅਸੀਂ ਲਚਕਤਾ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਸਾਨੂੰ ਹਰ ਤਰੀਕੇ ਨਾਲ ਆਸਨ ਆਸਾਨ ਮਹਿਸੂਸ ਕਰਾਉਂਦੀ ਹੈ ਸਰੀਰਕ ਲਚਕਤਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਜ ਜਦ ਸਾਡਾ ਸਰੀਰ ਲਚਕਦਾਰ ਹੁੰਦਾ ਹੈ ਤਾਂ ਅਸੀਂ ਬਿਨਾਂ ਕਿਸੇ ਤਕਲੀਫ ਦੇ ਹਰਕਤ ਕਰ ਸਕਦੇ ਹਾਂ ਸਾਡੀ ਮਾਸਪੇਸ਼ੀਆਂ ਜ਼ਿਆਦਾ ਆਰਾਮਦਾਇਕ ਰਹਿੰਦੀਆਂ ਹਨ ਅਤੇ ਸਾਨੂੰ ਕੋਈ ਵੀ ਕੰਮ ਕਰਨ ਵਿੱਚ ਥਕਾਵਟ ਮਹਿਸੂਸ ਨਹੀਂ ਨਹੀਂ ਹੁੰਦੀ ਲਚਕਤਾ ਵਧਾਉਣ ਲਈ ਸਾਡੀ ਦਿਨ ਚਰਿਆ ਵਿੱਚ ਸਟਰੈਚਿੰਗ ਯੋਗਾ ਅਤੇ ਹਲਕਾ ਫੁਲਕਾ ਵਰਕਆਊਟ ਸ਼ਾਮਿਲ ਕਰਨਾ ਬਹੁਤ ਲਾਭਕਾਰੀ ਹੁੰਦਾ ਹੈ ਉਦਾਹਰਨ ਵਜੋਂ ਜੇਕਰ ਅਸੀਂ ਹਰ ਰੋਜ਼ ਦਸ ਪੰਦਰ੍ਹਾਂ ਮਿੰਟ ਸਟਰੈਚ ਕਰੀਏ ਤਾਂ ਸਾਡੇ ਜੋੜ ਜੁਇੰਟਸ ਮਜ਼ਬੂਤ ਰਹਿੰਦੇ ਹਨ ਸਾਡੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਵਿੱਚ ਖਿੱਚ ਨਹੀਂ ਹੁੰਦੀ ਅਤੇ ਅਸੀਂ ਹਰ ਤਰੀਕੇ ਨਾਲ ਆਪਣੇ ਆਪ ਨੂੰ ਆਸਾਨ ਮਹਿਸੂਸ ਕਰਦੇ ਹਾਂ ਯੋਗਾ ਵੀ ਇੱਕ ਬਹੁਤ ਵਧੀਆ ਤਰੀਕਾ ਹੈ ਜੋ ਕਿ ਸਾਡੇ ਸਰੀਰ ਨੂੰ ਨਾ ਸਿਰਫ ਲਚਕਦਾਰ ਬਣਾਉਂਦਾ ਹੈ ਸਗੋਂ ਸਾਨੂੰ ਆਰਾਮ ਮਹਿਸੂਸ ਕਰਾਂਦਾ ਹੈ ਭੁਜੰਗ ਆਸਨ ਤਾੜ ਆਸਨ ਅਤੇ ਬਿਰਕ ਆਸਨ ਵਰਗੀਆਂ ਯੋਗ ਕਿਰਿਆਵਾਂ ਸਾਨੂੰ ਆਸਾਨੀ ਮਹਿਸੂਸ ਕਰਵਾਉਂਦੀਆਂ ਹਨ ਮਾਨਸਿਕ ਲਚਕਤਾ ਵੀ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ ਜੇਕਰ ਅਸੀਂ ਆਪਣੇ ਵਿਚਾਰਾਂ ਅਤੇ ਸੋਚਣ ਦੇ ਤਰੀਕੇ ਨੂੰ ਲਚਕਦਾਰ ਬਣਾਈਏ ਤਾਂ ਅਸੀਂ ਹਰ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰ ਸਕਦੇ ਹਾਂ ਜ਼ਿੰਦਗੀ ਵਿੱਚ ਹਰ ਰੋਜ਼ ਨਵੀਆਂ ਸਥਿਤੀਆਂ ਆਉਂਦੀਆਂ ਹਨ ਅਤੇ ਜੇਕਰ ਅਸੀਂ ਉਹਨਾਂ ਦੇ ਅਨੁਸਾਰ ਆਪਣੇ ਆਪ ਨੂੰ ਢਾਲਣ ਦੀ ਯੋਗਤਾ ਰੱਖਦੇ ਹਾਂ ਤਾਂ ਅਸੀਂ ਹੋਰ ਆਸਾਨ ਹੋ ਸਕਦੇ ਹਾਂ ਉਦਾਹਰਨ ਲਈ ਜੇਕਰ ਕੋਈ ਕੰਮ ਅਸੀਂ ਨਵੇਂ ਤਰੀਕੇ ਨਾਲ ਕਰੀਏ ਜਾਂ ਨਵੇਂ ਵਿਚਾਰ ਨੂੰ ਸਵੀਕਾਰ ਕਰੀਏ ਤਾਂ ਅਸੀਂ ਬਿਨਾਂ ਕਿਸੇ ਤਨਾਅ ਦੇ ਹਰ ਤਰ੍ਹਾਂ ਦੀ ਸਥਿਤੀ ਵਿੱਚ ਆਪਣੇ ਆਪ ਨੂੰ ਆਸਾਨ ਮਹਿਸੂਸ ਕਰਾ ਸਕਦੇ ਹਾਂ ਮਾਨਸਿਕ ਲਚਕਤਾ ਦੀ ਮਦਦ ਨਾਲ ਅਸੀਂ ਆਪਣੇ ਦਿਨਚਰਿਆ ਦੇ ਦਬਾਅ ਨੂੰ ਘਟਾ ਸਕਦੇ ਹਾਂ ਨਵੇਂ ਤਰੀਕਿਆਂ ਨੂੰ ਆਪਣਾ ਅਪਣਾ ਸਕਦੇ ਹਾਂ ਅਤੇ ਹਰ ਤਰ੍ਹਾਂ ਦੇ ਹਾਲਾਤਾਂ ਵਿੱਚ ਸ਼ਾਂਤੀ ਅਤੇ ਸੰਤੁਲਨ ਬਣਾਇਆ ਰੱਖਿਆ ਜਾ ਸਕਦਾ ਹੈ